ਜਿਵੇਂ ਕਿ ਸਭ ਨੂੰ ਪਤਾ ਕਿ ਸਾਡੀ ਇਹ ਧਰਤੀ ਵੀ ਇੱਕ ਬ੍ਰਹਿਮੰਡ ਦਾ ਬਹੁਤ ਵੱਡਾ ਹਿੱਸਾ ਹੈ ਇਸਦੇ ਵਿੱਚ ਬਹੁਤ ਸਾਰੇ ਕਿੱਤੇ ਪਾਏ ਜਾਂਦੇ ਹਨ ਬ੍ਰਹਿਮੰਡ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਲੱਗ ਅਲੱਗ ਸਮੇਂ 'ਤੇ ਵਿਗਿਆਨੀਆਂ ਨੇ ਪਤਾ ਲਗਾਈਆਂ ਹਨ ਅਤੇ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਨੇ ਆਦਿ ਗ੍ਰੰਥ ਦੇ ਵਿੱਚ ਵੀ ਦਰਜ ਕੀਤਾ ਹੈ ਕਿ ਇਸ ਬ੍ਰਹਿਮੰਡ ਦੇ ਵਿੱਚ ਲੱਖਾਂ ਹੀ ਧਰਤੀਆਂ ਅਤੇ ਲੱਖਾਂ ਹੀ ਪਤਾਲ ਹਨ ਜਿਸ ਨੂੰ ਕਿ ਨਾਸਾ ਨੇ ਵੀ ਮੰਨਿਆ ਹੈ ਕਿ ਹਾਂ ਇਹ ਗੱਲ ਸਹੀ ਹੈ ਲੇਕਿਨ ਇਹਦੀ ਨਿਰੰਤਰ ਖੋਜ ਜਾਰੀ ਹੈ ਔਰ ਨਾਸਾ ਆਪਣੇ ਸੋਰਸਾਂ ਤੋਂ ਹੁਣ ਤੱਕ ਅਲੱਗ ਅਲੱਗ ਬ੍ਰਹਿਮੰਡਾਂ ਬਾਰੇ ਪਤਾ ਲਗਾ ਰਹੀ ਹੈ ਕਿ ਇਸ ਬ੍ਰਹਮੰਡ ਦੇ ਵਿੱਚ ਇਸ ਧਰਤੀ ਤੋਂ ਸਿਵਾਏ ਹੋਰ ਕਿੱਥੇ ਕਿੱਥੇ ਜੀਵਨ ਸੰਭਵ ਹੈ ਜਿਸ ਦਾ ਕਿ ਅਜੇ ਪਤਾ ਲਗਾਉਣਾ ਬਾਕੀ ਹੈ ਜੋ ਕਿ ਬਹੁਤ ਹੀ ਇੱਕ ਦਿਲਚਸਪ ਗੱਲ ਹੈ ਕਿ ਵੀ ਇਸ ਧਰਤੀ ਤੋਂ ਸਿਵਾਏ ਪਹਿਲਾਂ ਵੀ ਇਸ ਧਰਤੀ ਤੋਂ ਅਲੱਗ ਅਲੱਗ ਬ੍ਰਹਿਮੰਡਾਂ ਦੇ ਵਿੱਚ ਦੁਨੀਆਂ ਲੋਕ ਰਹੇ ਨੇ ਅਤੇ ਹੁਣ ਵੀ ਰਹਿ ਰਹੇ ਨੇ ਜਿਹਨਾਂ ਬਾਰੇ ਅਜੇ ਨਾਸਾ ਨੂੰ ਵੀ ਚੰਗੀ ਤਰ੍ਹਾਂ ਨਹੀਂ ਪਤਾ ਲੱਗ ਸਕਿਆ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਰਹੱਸਾਂ ਬਾਰੇ ਪਤਾ ਲੱਗੇ ਕਿਨ ਆਕਾਸ਼ ਗੰਗਾਵਾਂ ਬਾਰੇ ਪਤਾ ਲੱਗੇ ਕਿ ਕਿਸ ਤਰ੍ਹਾਂ ਸਾਰੇ ਪਾਸੇ ਆਪਣਾ ਆਪਣਾ ਕੰਮ ਕਰਦੀਆਂ ਹਨ